ਹੈਲੋ ਹੈਲੋ ਸਰ ਆਪਣੇ ਮੈਂ ਕੰਟੀਨ 'ਤੇ ਆਇਆ ਸੀ ਤੁਹਾਡੇ ਅਤੇ ਆਪਾਂ ਫੂਡ ਆਰਡਰ ਕੀਤਾ ਸੀ ਫੂਡ ਲਿੱਤਾ ਸੀ ਛੋਲੇ ਭਟੂਰੇ ਪੀਜ਼ਾ ਅਤੇ ਉਹਨਾਂ ਵਿੱਚ ਆਪਾਂ ਨੂੰ ਬੜੀ ਪ੍ਰੋਬਲਮ ਆਈ ਹੈ ਇੱਕ ਤਾਂ ਹਾਈਜੀਨ ਬਿਲਕੁਲ ਮੈਨਟੇਨ ਨਹੀਂ ਸੀ ਅਤੇ ਓਈਲੀ ਜਿਹਾ ਸੀ ਆਪਾਂ ਥੋੜ੍ਹੇ ਟਾਈਮ ਪਹਿਲਾਂ ਹੀ ਆਏ ਸੀ ਆ ਦੋ ਕੁ ਦਿਨ ਹੋਏ ਹੈ ਹਾਂ ਅਤੇ ਨਹੀਂ ਕੁਆਲਿਟੀ ਵਰਤਿਆ ਗਿਆ ਜੋ ਪੀਜ਼ਾ ਸੀ ਨਾ ਵੀ ਪ੍ਰੋਕ ਪ੍ਰੋਪਰ ਪੈਕ ਹੈਗਾ ਸੀ ਅਤੇ ਛੋਲੇ ਤੁਹਾਨੂੰ ਪਤਾ ਓਈਲੀ ਹੈਗੇ ਸੀ ਅੱਜ ਕੱਲ੍ਹ ਓਈਲੀ ਤੁਹਾਨੂੰ ਪਤਾ ਹੀ ਹੈ ਕਿੰਨਾ ਸਿਹਤ ਲਈ ਵੀ ਆਪਣੇ ਕਿੰਨਾ ਖਰਾਬ ਹੈ ਅਤੇ ਅਤੇ ਜੋ ਬ ਸਮੋਸੇ ਵੀ ਤੁਹਾਡੇ ਆਰਡਰ ਕੀਤੇ ਸੀ ਮੈਂ ਅਤੇ ਸਮੋਸੇ ਵੀ ਮਤਲਬ ਬਿਲਕੁਲ ਵੀ ਅੰਦਰੋਂ ਨਾ ਤਾਂ ਬਿਲਕੁਲ ਖਰਾਬ ਐਵੇਂ ਸਮੈਲ ਆ ਰਹੀ ਸੀ ਬਿਲਕੁਲ ਐਂ ਜਿਵੇਂ ਬਹੁਤ ਮਤਲਬ ਬਹੁਤ ਘਟੀਆ ਸੀ ਸਮੋਸੇ ਵੀ ਜੀ ਜਾਓਗੇ ਪਰ ਹਾਈਜੀਨ ਤਾਂ ਮੇਨਟੇਨ ਹੋਣਾ ਹੀ ਚਾਹੀਦਾ ਨਾ ਨਹੀਂ ਗਰੁੱਪ ਅਤੇ ਆਪਣਾ ਗਰੁੱਪ ਆਇਆ ਸੀ ਪੂਰਾ ਕੰਟੀਨ 'ਤੇ ਅਤੇ ਕਿਸੇ ਨੇ ਵੀ ਮਤਲਬ ਆਪਾਂ ਸਿਰਫ਼ ਮੈਂ ਨਹੀਂ ਕਹਿ ਰਿਹਾ ਕਿਸੇ ਨੂੰ ਵੀ ਪੂਰੇ ਗਰੁੱਪ ਨੂੰ ਵੀ ਕੁਝ ਵਧੀਆ ਨਹੀਂ ਲੱਗਿਆ ਹਾਂ ਬਿਲਕੁਲ ਸਾਰੇ ਕਹਿੰਦੇ ਵੀ ਇਹ ਮਤਲਬ ਬਿਲਕੁਲ ਹਾਈਜੀਨ ਨਾ ਹਾਈਜੀਨ ਮੈਨਟੇਨ ਹੈ ਨਾ ਮਤਲਬ ਸਮੈਲ ਵੀ ਆ ਰਹੀ ਹੈ ਅਤੇ ਪ੍ਰੋਪਰ ਇਹਨਾਂ ਨੇ ਕੋਈ ਤਾਜ਼ਾ ਤਾਜ਼ਾ ਚੀਜ਼ਾਂ ਹੀ ਨਹੀਂ ਵਰਤੀਆਂ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਸੀ ਓ ਓਕੇ ਸਰ